ਮੈਂ ਆਪਣੇ ਪੜੋਸਣ ਨੂੰ ਬੁਣਨਾ ਵੀ ਸਿਖਾਇਆ ਸਿਲਾਈ ਵੀ ਸਿਖਾਈ ਹੈ ਅਤੇ ਉਸ ਨੂੰ ਡਿਜ਼ਾਈਨ ਪਾਉਣੇ ਵੀ ਸਿਖਾਏ ਨੇ ਉਸ ਨੂੰ ਸਿਲਾਈਆਂ 'ਤੇ ਉੱਨ ਦੇ ਕਿੰਨੇ ਜੋਟੇ ਪਾਉਣੇ ਜੋੜ ਪਾਉਣੇ ਮਤਲਬ ਕਿੰਨੇ ਉੱਨ ਦੇ ਕੁੰਡੇ ਪਾਉਣੇ ਆ ਫਿਰ ਉਸ ਨੂੰ ਬੁਣਨਾ ਹੈ ਉਹਦਾ ਬੋਰਡਰ ਬਣਾਉਣਾ ਫਿਰ ਉੱਤੇ ਡਿਜ਼ਾਇਨ ਪਾਉਣਾ ਮੈਂ ਉਹਨੂੰ ਸਿਖਾਏ ਉਹਨੇ ਮੇਰੇ ਕੋਲੋਂ ਘੱਟੋ ਘੱਟ ਦਸ ਸਵੈਟਰ ਬਣਾ ਕੇ ਬਹੁਤ ਖੁਸ਼ ਹੋਈ ਉਹ ਅੱਜ ਕੱਲ੍ਹ ਉਹ ਸਿੱਖ ਕੇ ਐਨੀ ਖੁਸ਼ ਹੋਈ ਵੀ ਹੈ ਅੱਗੇ ਉਹਨੂੰ ਬੁਣਨਾ ਆ ਗਿਆ